ਪੰਜਾਬੀ ਭੀ ਭਾਸ਼ਾ ਨੂੰ ਸੁਰੱਖਿਅਤ ਰੱਖਣ ਲਈ ਅਤੇ ਇਹਨੂੰ ਉਤਸ਼ਾਹਿਤ ਕਰਨ ਲਈ ਬਹੁਤ ਸਾਰੇ ਯਤਨ ਕੀਤੇ ਜਾ ਰਹੇ ਹੈ ਪਰ ਨੁਕਸਾਨ ਵਾਲੀ ਗੱਲ ਇਹ ਆ ਵੀ ਕੋਈ ਵੀ ਪੰਜਾਬ ਦੇ ਵਿੱਚ ਰਹਿੰਦੇ ਹੋਏ ਵੀ ਪੰਜਾਬੀ ਭਾਸ਼ਾ ਬੋਲਣਾ ਨਹੀਂ ਚਾਹੁੰਦਾ ਉਹ ਪੰਜਾਬੀ ਭਾਸ਼ਾ ਬੋਲਣ ਦੇ ਵਿੱਚ ਸ਼ਰਮ ਮੰਨਦੇ ਹੈਗੇ ਹੈ ਉਹਨਾਂ ਨੂੰ ਐਂ ਲੱਗਦਾ ਜੇ ਅਸੀਂ ਪੰਜਾਬੀ ਭਾਸ਼ਾ ਬੋਲਾਂਗੇ ਤਾਂ ਅਸੀਂ ਨੀਵੇਂ ਦਿਸਾਂਗੇ ਸੋ ਪੰਜਾਬੀ ਭਾਸ਼ਾ ਸਾਡੀ ਜਿਹੜੀ ਹੈਗੀ ਹੈ ਆਪਣੀ ਭਾਸ਼ਾ ਹੈਗੀ ਹੈ ਜਿਹੜੀ ਸਾਨੂੰ ਸਾਡੇ ਕਲਚਰ ਦੇ ਨਕਲ ਜੋੜਦੀ ਹੈਗੀ ਆ ਪੰਜਾਬ ਦੇ ਜਿਹੜੇ ਕਵੀ ਹੋਏ ਆ ਲੇਖਕ ਹੋਏ ਆ ਸੁਰਜੀਤ ਪਾਤਰ ਸ਼ਿਵ ਕੁਮਾਰ ਬਟਾਲਵੀ ਇਹਨਾਂ ਨੇ ਜਿਹੜੀ ਹੈਗੀ ਆ ਪੰਜਾਬੀ ਭਾਸ਼ਾ ਨੂੰ ਜਿਹੜਾ ਬਹੁਤ ਜ਼ਿਆਦਾ ਉੱਚਾ ਚੁੱਕਿਆ ਹੋਇਆ ਗਾ ਪੰਜਾਬੀ ਭਾਸ਼ਾ ਦਾ ਜਿਹੜਾ ਪੱਧਰ ਆ ਉਹ ਬਹੁਤ ਜ਼ਿਆਦਾ ਉੱਚਾ ਗਾ ਸਾਨੂੰ ਪੰਜਾਬੀ ਭਾਸ਼ਾ ਨੂੰ ਜਿਹੜਾ ਹੈਗਾ ਗਾ ਸਾਂਭ ਕੇ ਰੱਖਣਾ ਚਾਹੀਦਾ ਲੋਕਾਂ ਨੂੰ ਸਾਨੂੰ ਉਤਸ਼ਾਹਿਤ ਕਰਨਾ ਚਾਹੀਦਾ ਲੋਕ ਉਤਸ਼ਾਹਿਤ ਕਰਨ ਵਾਸਤੇ ਬਹੁਤ ਸਾਰੇ ਯਤਨ ਕੀਤੇ ਜਾਣੇ ਚਾਹੀਦੇ ਹੈ ਜਿਵੇਂ ਸੈਮੀਨਾਰ ਲੱਗਦੇ ਹੈਗੇ ਆ ਪੰਜਾਬੀ ਭਾਸ਼ਾ ਨੂੰ ਉਤਸ਼ਾਹਿਤ ਕਰਨ ਵਾਸਤੇ ਚਾਰਟਸ ਰਾਹੀਂ ਅਸੀਂ ਪੰਜਾਬੀ ਭਾਸ਼ਾ ਨੂੰ ਅੱਗੇ ਲੈ ਕੇ ਜਾ ਸਕਦੇ ਹੈਗੇ ਹਾਂ ਕੋਈ ਵੀ ਅਸੀਂ ਜੇ ਫਾਮ ਫਿੱਲ ਕਰਨਾ ਹੈਗਾ ਤਾਂ ਸਾਨੂੰ ਪਹਿਲਾਂ ਆਪਣੀ ਜਿਹੜੀ ਹੈਗੀ ਹੈ ਪੰਜਾਬੀ ਭਾਸ਼ਾ ਹੀ ਹੈ ਜਿਹੜੀ ਉਸਨੂੰ ਮੁੱਖ ਰੱਖਣਾ ਚਾਹੀਦਾ ਹੈਗਾ ਪਿੰਡਾਂ ਦੇ ਵਿੱਚ ਬਹੁਤ ਜ਼ਿਆਦਾ ਅਵੇਅਰਨੈਸ ਕੈਂਪ ਹੋਣੇ ਚਾਹੀਦਾ ਹੈ ਜਿਸਦੇ ਵਿੱਚ ਪੰਜਾਬੀ ਭਾਸ਼ਾ ਹੀ ਹੈ ਜਿਹੜੀ ਹੋਏਗੀ ਉਹ ਮੂਹਰੇ ਹੋਣੀ ਚਾਹੀਦੀ ਆ ਸਾਨੂੰ ਆਪਣੇ ਬੱਚਿਆਂ ਨੂੰ ਜਿਹੜਾ ਹੈਗਾ ਗਾ ਉਹ ਚਾਹੀਦਾ ਹੈਗਾ ਕਿ ਉਹ ਬੱਚੇ ਜਿਹੜੇ ਹੈਗੇ ਹੈਗੇ ਆਪਣੇ ਨਾਲ ਆਪਣੇ ਮਾਤਾ ਪਿਤਾ ਦੇ ਨਾਲ ਫਰੈਂਡਸ ਦੇ ਨਾਲ ਜਿਹੜੇ ਹੈਗੇ ਹੈਗੇ ਪੰਜਾਬੀ ਭਾਸ਼ਾ ਦੇ ਵਿੱਚ ਗੱਲ ਕਰਨ ਨਾ ਕੇ ਆਪਾਂ ਇੰਗਲਿਸ਼ ਨੂੰ ਅਤੇ ਹਿੰਦੀ ਨੂੰ ਵੀ ਮੂਹਰੇ ਲੈ ਕੇ ਆ ਕੇ ਹਾਂ ਉਹ ਭਾਸ਼ਾਵਾਂ ਵੀ ਬੋਲਣੀਆਂ ਚਾਹੀਦੀਆਂ ਬੱਟ ਆਪਾਂ ਨੂੰ ਆਪਣੀ ਜਿਹੜੀ ਹੈਗੀ ਹੈ ਪੰਜਾਬੀ ਭਾਸ਼ਾ ਜਿਹੜੀ ਹੈਗੀ ਬਚਾਉਣੀ ਚਾਹੀਦੀ ਹੈਗੀ ਆ ਵੱਧ ਤੋਂ ਵੱਧ ਨੂੰ ਇਸਦੇ ਬਾਰੇ ਦੱਸਣਾ ਚਾਹੀਦਾ ਆਪਾਂ ਨੂੰ ਪੰਜਾਬੀ ਭਾਸ਼ਾ ਜਿਹੜੀ ਹੈਗੀ ਆ ਸੰਭਾਲ ਕੇ ਰੱਖਣੀ ਚਾਹੀਦੀ ਹੈ ਇਹਨੂੰ ਬਚਾਉਣ ਵਾਸਤੇ ਅਲੱਗ ਅਲੱਗ ਯਤਨ ਕੀਤੇ ਜਾਣੇ ਜਾ ਸਕਦੇ ਹੈਗੇ ਐ ਜਿਵੇਂ ਆਪਾਂ ਪਿੰਡ ਦੇ ਵਿੱਚ ਸੱਥਾਂ ਦੇ ਵਿੱਚ ਜਾ ਕੇ ਓੱਥੇ ਪੰਜਾਬੀ ਬੋਲੀਏ ਬੱਚਿਆਂ ਨੂੰ ਓੱਥੇ ਲੈ ਕੇ ਜਾ ਕੇ ਸਕੂਲਾਂ ਵਿੱਚ ਕੋਲਜਾਂ ਵਿੱਚ ਪਿੰਡਾਂ ਵਿੱਚ ਕਲੱਬ ਬਣਾਕੇ ਸੈਮੀਨਾਰ ਕਰਵਾ ਕੇ ਜਿਸ ਵਿੱਚ ਪੰਜਾਬੀ ਭਾਸ਼ਾ ਬਾਰੇ ਸਾਰਾ ਕੁਛ ਦੱਸਿਆ ਜਾਵੇ ਪੰਜਾਬੀ ਭਾਸ਼ਾ ਦਾ ਮੇਨ ਮਕਸਦ ਕੀ ਹੈ ਇਹ ਕਿੱਥੋਂ ਆਈ ਇਹਨਾਂ ਦੇ ਸਰਜੀ ਜਿਹੜੇ ਆਪਣੇ ਪੰਜਾਬੀ ਕਵੀ ਹੋਏ ਹੈ ਲੇਖਕ ਹੋਏ ਆ ਉਹਨਾਂ ਬਾਰੇ ਬੱਚਿਆਂ ਨੂੰ ਸਾਰੇ ਵੱਡਿਆਂ ਨੂੰ ਸਾਰਿਆਂ ਨੂੰ ਆਪਾਂ ਅਵੇਅਰਨੈਸ ਕੀਤੀ ਜਾਵੇ